ਖਾਣਾ ਬਣਾਉਣਾ ਮੇਰੀ ਮੇਰਾ ਪਸੰਦੀਦਾ ਕੰਮ ਹੈ ਮੈਨੂੰ ਖਾਣਾ ਬਣਾ ਕੇ ਖੁਸ਼ੀ ਮਿਲਦੀ ਹੈ ਜਦੋਂ ਮੈਂ ਨਵੀਂ ਨਵੀਂ ਚੀਜ਼ਾਂ ਬਣਾ ਕੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਫਰੈਂਡਸ ਨੂੰ ਖਲਾਂਦੀ ਹਾਂ ਅਤੇ ਮੈਨੂੰ ਉਸ ਚੀਜ਼ 'ਚ ਸਕੂਨ ਮਿਲਦਾ ਆ ਮੇਰੀ ਮੈਂ ਜਦੋਂ ਉਦਾਸ ਹੁੰਦੀ ਹਾਂ ਮੈਨੂੰ ਉਦੋਂ ਵੀ ਖਾਣਾ ਪਕਾਉਣਾ ਅੱਛਾ ਲੱਗਦਾ ਅਤੇ ਜਦੋਂ ਮੈਂ ਖੁਸ਼ ਹੁੰਦੀ ਹਾਂ ਮੈਨੂੰ ਉਦੋਂ ਵੀ ਕਿਉਂਕਿ ਮੈਨੂੰ ਜਦੋਂ ਮੈਂ ਆਪਣੇ ਵਿਹਲੇ ਟਾਈਮ ਵਿੱਚ ਵੀ ਮੈਂ ਕੁਕਿੰਗ ਕਰਨਾ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਮੈਨੂੰ ਨਵੀਂ ਨਵੀਂ ਚੀਜ਼ਾਂ ਨੂੰ ਬਣਾਉਣਾ ਅਤੇ ਨਵੇਂ ਨਵੇਂ ਤਰੀਕਿਆਂ ਨੂੰ ਅਜ਼ਮਾਉਣਾ ਅਤੇ ਨਵੇਂ ਨਵੇਂ ਚੀਜ਼ਾਂ ਨੂੰ ਟੇਸਟ ਕਰਨਾ ਅੱਛਾ ਲੱਗਦਾ ਅਤੇ ਮੈਨੂੰ ਖੁਸ਼ ਹੁੰਦੀ ਹਾਂ ਮੈਂ ਇਸ ਚੀਜ਼ ਨੂੰ ਲੈ ਕੇ ਕਿ ਮੈਂ ਨਵੀਂ ਨਵੀਂ ਚੀਜ਼ਾਂ ਬਣਾ ਕੇ ਆਪਣੀ ਫੈਮਲੀ ਨੂੰ ਖੁਆਉਂਦੀ ਹਾਂ ਅਤੇ ਮੇਰਾ ਮਨ ਹੈ ਕਿ ਮੈਂ ਕਦੀ ਕਦੀ ਐਵੇਂ ਦੀਆਂ ਚੀਜ਼ਾਂ ਖਾਣੇ ਦੀਆਂ ਬਣਾ ਕੇ ਬਾਹਰ ਵੀ ਲੋੜਵੰਦ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਵੰਡਾਂ ਅਤੇ ਮੈਨੂੰ ਇਹ ਚੀਜ਼ ਖੁਸ਼ੀ ਦਿੰਦੀ ਹੈ